ਖੇਡਾਂ ਦੀਆਂ ਖਬਰਾਂ ਟਾਈਮ ਟੂ ਟਾਈਮ ਇਹਨਾਂ ਦੇ ਜਿੰਨੇ ਵੀ ਟੂਰਨਾਮੈਂਟ ਆ ਪ੍ਰੋਗਰਾਮਸ ਹੁੰਦੇ ਆ ਅੱਜ ਕੱਲ੍ਹ ਤਾਂ ਆਪਣੇ ਕੋਲ ਇੰਟਰਨੈਟ ਦੀ ਸੁਵਿਧਾ ਹੈਗੀ ਆ ਤਾਂ ਟਾਈਮ ਟੂ ਟਾਈਮ ਫੋਨ ਦੇ ਉੱਤੇ ਨੋਟੀਫਿਕੇਸ਼ਨਸ ਆਉਂਦੇ ਰਹਿੰਦੇ ਆ ਬਕਾਇਦਾ ਸਪੋ ਨਿਊਜ਼ ਚੈਨਲਜ਼ ਤੋਂ ਜਾਂ ਯੂਟਿਊਬ ਤੋਂ ਜਾਂ ਯੂਟਿਊਬ ਦੇ ਉੱਤੇ ਜਿਹੜੇ ਸਪੋਰਟਸ ਚੈਨਲ ਹੁੰਦੇ ਆ ਉਹਨਾਂ ਦੀ ਹੈਲਪ ਤੋ ਵੀ ਪਤਾ ਲੱਗ ਜਾਂਦੀਆਂ ਨੇ ਲੇਕਿਨ ਅੱਜ ਕੱਲ੍ਹ ਤਾਂ ਜਿਹੜਾ ਗੂਗਲ ਹੈ ਗੂਗਲ ਦੇ ਉੱਤੇ ਹੀ ਆਪਾਂ ਨੂੰ ਨੋਟੀਫਿਕੇਸ਼ਨ ਆ ਜਾਂਦੀ ਹੈ ਜੇ ਆਪਾਂ ਉਹਨੂੰ ਆਪਣੇ ਅਟੈਚ ਕਰ ਰੱਖੀਏ ਅਤੇ ਐਕ ਨੋਟੀਫਿ ਨੋਟੀਫਿਕੇਸ਼ਨਸ ਆਨ ਕਰ ਰੱਖੀਏ ਤਾਂ ਇਹਨਾਂ ਦੇ ਥਰੂ ਆਪਾਂ ਨੂੰ ਸ਼ੋਸਲ ਇੰਟਰਨੈਟ ਦੀ ਮਦਦ ਨਾਲ ਜਾਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵੀ ਆਪਾਂ ਨੂੰ ਸਪੋਰਟਸ ਦੀਆਂ ਜਿੰਨੀਆਂ ਵੀ ਅਪ ਟੂ ਡੇਟ ਖਬਰਾਂ ਨੇ ਇਹ ਸਭ ਪਤਾ ਲੱਗਦੀਆਂ ਰਹਿੰਦੀਆਂ ਨੇ ਕੋਈ ਇੱਕ ਖੇਡ ਨਹੀਂ ਲੇਕਿਨ ਜਿਵੇਂ ਕਿ ਕਈ ਖੇਡਾਂ ਨੇ ਜਿਨ੍ਹਾਂ ਦਾ ਪਾਲਣ ਪਾਲਣਾ ਕਰਦੇ ਹਾਂ ਜਿਵੇਂ ਕਿ ਬੈਡਮਿੰਟਨ ਹੋ ਗਿਆ ਖੋ ਖੋ ਹੋ ਗਿਆ ਅਤੇ ਸਪੋਰਟਸ ਬਹੁਤ ਵਾਸਟ ਹੈ ਅਤੇ ਹਰ ਇੱਕ ਸਪੋਰਟਸ ਦਾ ਅੱਡ ਅੱਡ ਕ੍ਰਾਈਟ੍ਰੀਆ ਹੈ ਅਤੇ ਅੱਡ ਅੱਡ ਹੀ ਅੱਗੇ ਰੂਲਜ਼ ਰੈਗੂਲੇਸ਼ਨਸ ਹੁੰਦੀਆਂ ਨੇ